ਮੈਂ ਕਈ ਵਾਰ ਪੰਛੀ ਓਹਲੇ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜੇ ਮੈਂ ਪੰਛੀ ਨੂੰ ਉਸਦੇ ਸਾਹਮਣੇ ਜਾ ਕੇ ਦੇਖਣ ਦੀ ਕੋਸ਼ਿਸ਼ ਕਰਾਂ ਤਾਂ ਉਹ ਉੱਡ ਜਾਂਦੇ ਹਨ ਕਿਉਂਕਿ ਉਹ ਡਰ ਜਾਂਦੇ ਹਨ ਪੰਛੀ ਕਈ ਵਾਰ ਉਹਨਾਂ ਨੂੰ ਆਹ ਲੱਗਦਾ ਹੈ ਕਿ ਅਸੀਂ ਉਹਨਾਂ ਨੂੰ ਫੜ ਕੇ ਅਸੀਂ ਬੰਧਕ ਬਣਾ ਲਵਾਂਗੇ ਕਈ ਵਾਰੀ ਮੈਂ ਆਪਣੇ ਦੋਸਤਾਂ ਦੇ ਨਾਲ ਸਾਡੇ ਘਰ ਦੇ ਸਾਹਮਣੇ ਵਾਲੇ ਬਗੀਚੇ ਵਿੱਚ ਜਾ ਕੇ ਪੰਛੀਆਂ ਨੂੰ ਦੇਖਿਆ ਹੈ ਇਹ ਸਾਡੀ ਕੁਦਰਤ ਦਾ ਇੱਕ ਅਲੱਗ ਹੀ ਨਜ਼ਾਰਾ ਹੈ ਪੰਛੀ ਦੇਖਣ ਦੇ ਹੋਰ ਵੀ ਵੱਖਰੇ ਤਰੀਕੇ ਆ ਨਾਲ ਇਸਦੀ ਤੁਲਨਾ ਕੀਤੀ ਜਾ ਸਕਦੀ ਹੈ ਅਸੀਂ ਕਈ ਵਾਰ ਪੇੜ ਉੱਪਰ ਚੜ੍ਹ ਕੇ ਲੁਕ ਲੁਕ ਕੇ ਇਹਨਾਂ ਪੰਛੀਆਂ ਨੂੰ ਦੇਖਿਆ ਇਹ ਕੀ ਕਰਦੇ ਹਨ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਇਹ ਪਾਲਦੇ ਹਨ ਉਹਨਾਂ ਦੀ ਦੇਖਭਾਲ ਕਰਦੇ ਹਨ ਅਸੀਂ ਕਈ ਵਾਰ ਪੇੜਾਂ ਉੱਤੇ ਚੜ੍ਹ ਕੇ ਆਹ ਵੀ ਦੇਖਿਆ ਹੈ ਕਿ ਇਹ ਪੰਛੀ ਕਿਸ ਤਰ੍ਹਾਂ ਆਪਣੇ ਅੰਡਿਆਂ ਦੀ ਸੰਭਾਲ ਕਰਦੇ ਹਨ ਅਸੀਂ ਕਈ ਵਾਰ ਛੁਪਦੇ ਛੁਪਾਂਦੇ ਕਈ ਵਾਰੀ ਆਪਣੇ ਉੱਪਰ ਕਈ ਚੀਜ਼ਾਂ ਢੱਕ ਕੇ ਇਹਨਾਂ ਪੰਛੀਆਂ ਨੂੰ ਦੇਖਿਆ ਕਰਦੇ ਸੀ ਇਹ ਮੇਰੇ ਬਚਪਨ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਦਿੰਦਾ ਹੈ ਮੈਂ ਕਈ ਵਾਰ ਆਪਣੇ ਦੋਸਤ ਜਤਿਨ ਦੇ ਨਾਲ ਆਪਣੇ ਸਾਹਮਣੇ ਬਗੀਚੇ 'ਚ ਜਾਂਦਾ ਸੀ ਧੰਨਵਾਦ